ਖੇਤ ਜਾਂ ਘਰ ਵਿੱਚ ਕੰਮ ਕਰਦੇ ਹੋਏ ਵਿਅਕਤੀ ਕੋਈ ਨਾ ਕੋਈ ਮਨੋਰੰਜਨ ਦਾ ਸਾਧਨ ਲੱਭ ਹੀ ਲੈਂਦਾ ਹੈ ਕਿਉਂਕਿ ਮਨੋਰੰਜਨ ਕਰਦੇ ਹੋਏ ਕੰਮ ਜਲਦੀ ਵੀ ਹੋ ਜਾਂਦਾ ਹੈ ਜਿਵੇਂ ਕਿ ਆਪਾਂ ਖੇਤੀਬਾੜੀ ਹੀ ਲੈ ਲਈਏ ਖੇਤੀਬਾੜੀ ਵਿੱਚ ਹਲ ਵਾਹੁਣ ਵਾਹੁਣ ਸਮੇਂ ਅੱਜ ਕੱਲ ਨੌਜਵਾਨ ਜਿਹੜੇ ਆ ਡੈੱਕ ਵਗੈਰਾ ਲਗਾ ਲੈਂਦੇ ਨੇ ਤਾਂ ਜੋ ਉਹ ਆਪਣਾ ਆਸਾਨੀ ਨਾਲ ਮਨੋ ਕੰਮ ਕਰ ਸਕਣ ਅਤੇ ਆਪਣਾ ਮਨੋਰੰਜਨ ਵੀ ਕਰ ਸਕਣ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਜਿਹੜੀਆਂ ਔਰਤਾਂ ਨੇ ਉਹ ਵੀ ਘਰ ਦਾ ਕੰਮ ਕਰਦੀਆਂ ਹੋਈਆਂ ਮਨੋਰੰਜਨ ਕਰਦੀਆਂ ਹਨ ਜਿਵੇਂ ਕਿ ਪਹਿਲਾਂ ਵਾਲੀਆਂ ਜਿਹੜੀਆਂ ਔਰਤਾਂ ਸੀ ਉਹ ਆਪਣੇ ਘਰ ਦੇ ਕੰਮ ਕਰਦੇ ਕਰਦੇ ਗੁਨ ਗੁਨਾ ਗੀਤ ਪੰਜਾਬੀ ਗੀਤ ਗਾਉਂਦੀਆਂ ਰਹਿੰਦੀਆਂ ਸੀ ਪਰ ਅੱਜ ਕੱਲ ਅੱਜ ਕੱਲ ਏਅਰ ਅੱਜ ਕੱਲ ਹੈਡਫੋਨ ਦਾ ਜ਼ਮਾਨਾ ਹੈ ਅੱਜ ਕੱਲ ਫੋਨ 'ਤੇ ਗੀਤ ਵਗੈਰਾ ਲਾ ਕੇ ਹੀ ਕੰਮ ਕੀਤਾ ਜਾਂਦਾ ਹੈ ਇਸ ਨਾਲ ਘਰ ਦਾ ਕੰਮ ਵੀ ਹੋ ਜਾਂਦਾ ਹੈ ਅਤੇ ਲੋਕ ਮਨੋਰੰਜਨ ਵੀ ਕਰਦੇ ਨੇ ਮਨੋਰੰ ਮਨੋਰੰਜਨ ਕਰਦੇ ਕਰਦੇ ਕੰਮ ਕਰਨਾ ਆਸਾਨ ਹੋ ਜਾਂਦਾ ਹੈ ਇਸ ਲਈ ਨਾਲ ਨਾਲ ਲੋਕ ਗੀਤ ਗਾਉਂਦੇ ਕੰਮ ਕਰ ਨਾਲ ਨਾਲ ਲੋਕ ਗੀਤ ਗਾਉਂਦੇ ਕੰਮ ਕਰਦੇ ਕੰਮ ਕਰਨਾ ਚਾਹੀਦਾ ਹੈ ਇਸ ਲਈ ਇਸ ਲਈ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਜਿਵੇਂ ਕਿ ਗੀਤ ਵਗੈਰਾ ਸੁਣ ਕੇ ਜਾਂ ਗਾ ਕੇ ਮੋਨੋਰੰਜਨ ਕ ਕੀਤਾ ਜਾ ਸਕਦਾ ਹੈ ਅਤੇ ਕੰਮ ਵੀ ਆਸਾਨੀ ਨਾਲ ਹੋ ਜਾਂਦਾ ਹੈ